ਭਾਰਤ ਦੀਆਂ ਕੁਝ ਥਾਵਾਂ ਜਿੱਥੇ ਅਸੀਂ ਸੈਂਕਲ ਰਾਹੀਂ ਗਏ ਹਾਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਸਾਈਕਲਿੰਗ ਕਰਕੇ ਚੰਡੀਗੜ੍ਹ ਗਏ ਹਾਂ ਚੰਡੀਗੜ੍ਹ ਦੇ ਵਿੱਚ ਅਸੀਂ ਕਾਫੀ ਸਾਈਕਲਿੰਗ ਕੀਤੀ ਹੈ ਚੰਡੀਗੜ੍ਹ ਸਾਈਕਲ ਪੁਆਇੰਟ ਬਣੇ ਹੋਏ ਹਨ ਜੋ ਮਾਰਕਿੰਗ ਹੋਈ ਹੋਈ ਹੈ ਆਲੇ ਦੁਆਲੇ ਅਤੇ ਉੱਥੇ ਵਧੀਆ ਤਰੀਕੇ ਨਾਲ ਬੱਸਾਂ ਤੋਂ ਅਤੇ ਟਰੈਫਿਕ ਤੋਂ ਬਚ ਕੇ ਸਾਈਕਲਿੰਗ ਦਾ ਆਨੰਦ ਲਿਆ ਜਾ ਸਕਦਾ ਹੈ ਅਤੇ ਅਸੀਂ ਮੋਹਾਲੀ ਦੇ ਵਿੱਚ ਅਤੇ ਅਸੀਂ ਲੰਬੇ ਰੂਟ 'ਤੇ ਕਾਫੀ ਸਾਈਕਲਿੰਗ ਕੀਤੀ ਹੈ ਅਸੀਂ ਹੁਣ ਚਾਹੁੰਦੇ ਹਾਂ ਕਿ ਅਸੀਂ ਸੈਂਕਲ ਦੇ ਰਾਹੀਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸਾਈਕਲਿੰਗ ਕਰਕੇ ਜਾਈਏ ਅਤੇ ਸਾਡੇ ਮਨ ਦਾ ਜਲਦੀ ਇਹ ਚਾਹੁੰਦੇ ਹਾਂ ਕਿ ਅਸੀਂ ਲੁਧਿਆਣਾ ਅਤੇ ਜਲੰਧਰ ਸਾਇਡ ਸਾਈਕਲਿੰਗ ਕਰਕੇ ਅਸੀਂ ਸੈਂਕਲ 'ਤੇ ਜਾਈਏ ਅਤੇ ਸਾਈਕਲਿੰਗ ਦੇ ਨਾਲ ਸਾਡਾ ਸਰੀਰ ਹੈ ਤਾਂ ਬਿਲਕੁਲ ਤੰਦਰੁਸਤ ਰਹਿੰਦਾ ਹੈ ਇਸ ਲਈ ਅਸੀਂ ਸੈਂਕਲ ਚਲਾਉਣਾ ਚਾਹੁੰਦੇ ਹਾਂ ਅਤੇ ਸਾਡੇ ਸਾਡੀ ਸਿਫਾਰਿਸ਼ ਇਹ ਹੈ ਕਿ ਸਾਈਕਲਿੰਗ ਹੈ ਜੋ ਕਰਨੀ ਚਾਹੀਦੀ ਹੈ ਸਾਈਕਲਿੰਗ ਦੇ ਨਾਲ ਵਧੀਆ ਵਧੀਆ ਪੁਆਇੰਟਾਂ 'ਤੇ ਜਾਣਾ ਹੈ ਚਾਹੀਦਾ ਹੈ ਪਰ ਪਹਾੜੀ ਏਰੀਏ ਦੇ ਵਿੱਚ ਸਾਈਕਲਿੰਗ ਕਰਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਕਿਉਂਕਿ ਸਾਈਕਲਿੰਗ ਕਰਨ ਵਾਲੇ ਜੋ ਟਰੈਕ ਬਣੇ ਹੁੰਦੇ ਹਨ ਜੋ ਖੇਡਾਂ ਹੁੰਦੀਆਂ ਹਨ ਉਹਨਾਂ ਦੇ ਲਈ ਸਾਈਕਲਿੰਗ ਕਰਨੀ ਬਿਲਕੁਲ ਠੀਕ ਹੈ ਪਰ ਜੋ ਆਮ ਲੋਕ ਹਨ ਪਹਾੜੀ ਏਰੀਏ ਦੇ ਵਿੱਚ ਸਾਈਕਲਿੰਗ ਬਿਲਕੁਲ ਸੇਫ ਨਹੀਂ ਹੈ ਸਾਈਕਲਿੰਗ ਪੱਧਰ ਜਗ੍ਹਾ 'ਤੇ ਵਧੀਆ ਰੋਡ 'ਤੇ ਹੀ ਕਰਨੀ ਚਾਹੀਦੀ ਹੈ ਅਤੇ ਸਾਡੀ ਸਿਫਾਰਿਸ਼ ਇਹ ਹੈ ਵੀ ਸਾਈਕਲਿੰਗ ਹੈ ਜੋ ਕਰਨੀ ਚਾਹੀਦੀ ਹੈ